ਇਹ ਪਹਿਲਾ ਪ੍ਰੋਡਕਟ ਹੈ ਮੋਬਾਇਲ ਫੋਨ ਜੋ ਮੈਂ ਔਨਲਾਈਨ ਖਰੀਦਿਆ ਔਰ ਖਰੀਦਣ ਤੋਂ ਪਹਿਲਾਂ ਮੈਂ ਬਹੁਤ ਸਾਰੇ ਮੋਬਾਈਲ ਫੋਨਸ ਦੇ ਸਰਚ ਕੀਤੇ ਉਸ ਦੇ ਬਹੁਤ ਸਾਰੇ ਸਿਮੀਲਰ ਪ੍ਰੋਡਕਟਸ ਦੇ ਫੀਚਰਸ ਵੀ ਕੰਪੇਅਰ ਕੀਤੇ ਔਰ ਕੰਪੇਅਰ ਕਰਨ ਤੋਂ ਬਾਅਦ ਜੋ ਮੈਂ ਚਾਹੁੰਦਾ ਸੀ ਉਹ ਮੈਨੂੰ ਮਿਲਿਆ ਔਰ ਜਿਹੜੇ ਫੀਚਰ ਮੈਂ ਸਰਚ ਕਰ ਰਿਹਾ ਸੀ ਉਹੀ ਮੈਨੂੰ ਮਿਲ ਗਏ ਇੱਕ ਜ਼ਰੂਰੀ ਗੱਲ ਮੈਂ ਇੱਥੇ ਕਰਨਾ ਚਾਹਾਂਗਾ ਕਿ ਇਹ ਪ੍ਰੋਡਕਟ ਜੋ ਹੈ ਮੇਰੇ ਲੋਕਲ ਮਾਰਕੀਟ ਵਿੱਚ ਉਪਲਬਧ ਨਹੀਂ ਸੀ ਔਰ ਦੂਜਾ ਦੀਵਾਲੀ ਦੀ ਸੇਲ ਦੇ ਕਾਰਨ ਇਹ ਪ੍ਰੋਡਕਟ ਬਹੁਤ ਹੀ ਚੰਗੇ ਡਿਸਕਾਊਂਟਡ ਰੇਟ 'ਤੇ ਮੈਨੂੰ ਉਪਲਬਧ ਹੋਇਆ ਸੋ ਡਿਸਕਾਊਂਟਡ ਰੇਟ ਦੇ ਉੱਤੇ ਮੈਨੂੰ ਇਹ ਲੱਗਦਾ ਕਿ ਇਹ ਸ ਬੈਸਟ ਫੀਚਰ ਉਪਲਬਧ ਹਨ ਔਰ ਅਗਲੀ ਗੱਲ ਇਹ ਕਿ ਇਸਦਾ ਜੋ ਰਿਟਰਨ ਪੀਰੀਅਡ ਹੈ ਮੋਬਾਇਲ ਫੋਨ ਨੂੰ ਆਪਾਂ ਯੂਜ ਕਰਕੇ ਅਗਰ ਕੋਈ ਫੀਚਰ ਇਸਦਾ ਚੰਗਾ ਨਹੀਂ ਲੱਗਿਆ ਤਾਂ ਵੀ ਸੱਤ ਦਿਨ ਦਾ ਜੋ ਗਰੇਸ ਪੀਰੀਅਡ ਰਿਟਰਨ ਪੀਰੀਅਡ ਹੈ ਉਸ ਨੂੰ ਅਸੀਂ ਵਾਪਸ ਵੀ ਹੀ ਵਾਪਸ ਵੀ ਕਰ ਸਕਦੇ ਹਾਂ ਹੁਣ ਦੋ ਮਹੀਨੇ ਤੋਂ ਮੈਂ ਇਸ ਦੀ ਵਰਤੋਂ ਕਰ ਰਿਹਾ ਹਾਂ ਔਰ ਇਸਦੀ ਕੈਮਰੇ ਦੇ ਕੁਆਲਿਟੀ ਬਹੁਤ ਚੰਗੀ ਆ ਅਰ ਬੈਟਰੀ ਦੀ ਕਪੈਸਿਟੀ ਬਹੁਤ ਜ਼ਿਆਦਾ ਹੈ ਔਰ ਪਰ ਜੇ ਆਪਾਂ ਗੇਮਾਂ ਖੇਡੀਏ ਤਾਂ ਗੇਮਾਂ ਖੇਡਣ ਨਾਲ ਇਸਦੀ ਬੈਟਰੀ ਜਲਦੀ ਖਤਮ ਹੋ ਜਾਂਦੀ ਹੈ ਸੋ ਮੈਂ ਇਸ ਪ੍ਰੋਡਕਟ ਤੋਂ ਬਹੁਤ ਖੁਸ਼ ਹਾਂ ਅਤੇ ਮੈਂ ਇਹ ਇੱਕ ਬਜਟ ਫੋਨ ਹੈ